ਪੰਜਾਬੀ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ ਇਹ ਸਿੱਖ ਧਰਮ ਨਾਲ ਸੰਬੰਧਿਤ ਹੈ ਪੰਜਾਬੀ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਲਿਖੀ ਜਾਂਦੀ ਹੈ ਇਹ ਦੇਵਨਾਗਰੀ ਹਿੰਦਰੀ ਹਿੰਦੀ ਤੋਂ ਵੱਖਰੀ ਹੈ ਇਹ ਬਹੁਤ ਹੀ ਪਿਆਰੀ ਅਤੇ ਮਿੱਠੀ ਭਾਸ਼ਾ ਹੈ ਇਸ ਭਾਸ਼ਾ ਵਿੱਚ ਬਹੁਤ ਸਾਰੇ ਸੰਸਾਰ ਦੇ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖੇ ਹੋਏ ਹਨ ਇਹ ਭਾਸ਼ਾ ਨੂੰ ਅੰਤਰ ਰਾਸ਼ਟਰੀ ਭਾਸ਼ਾ ਹੋਣਾ ਚਾਹੀਦਾ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਗਿਆਨ ਨੂੰ ਰੱਬ ਦੇ ਸ ਸਮਾਨ ਸਮਝਣ ਲਈ ਗੁਰਮੁਖੀ ਸਿੱਖਣੀ ਬਹੁਤ ਜ਼ਰੂਰੀ ਹੈ ਪੰਜਾਬੀ ਅਖਬਾਰ ਅਜੀਤ ਡੇਲੀ ਪੰਜਾਬ ਦਾ ਸਭ ਤੋਂ ਵੱਧ ਛਪਣ ਵਾਲਾ ਅਖਬਾਰ ਜੋ ਕਿ ਜਲੰਧਰ ਤੋਂ ਹੈ ਸਾਧੂ ਸਿੰਘ ਹਮਦਰਦ ਇਸ ਅ ਅਜੀਤ ਡੇਲੀ ਅਖਬਾਰ ਦੇ ਸੰਪਾਦਕ ਹਨ ਗਿਆਰ੍ਹਾਂ ਦਸੰਬਰ ਦੋ ਹਜ਼ਾਰ ਸਤਾਰ੍ਹਾਂ ਵਿੱਚ ਪਹਿਲਾ ਪੰਜਾਬੀ ਅਖਬਾਰ ਗਿਆਰ੍ਹਾਂ ਅਖਬਾਰ ਨਵਾਂ ਗਿਆਰ੍ਹਾਂ ਦਸੰਬਰ ਦੋ ਹਜ਼ਾਰ ਸਤਾਰ੍ਹਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ ਮਿਸਟਰ ਸਵਰਾਜ ਵੀਰ ਸਿੰਘ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਹਨ ਰੇਡੀਓ ਟੈਲੀਵਿਜ਼ਨ ਅਤੇ ਮੀਡੀਆ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਜ਼ਿਆਦਾ ਵਰਤੀ ਜਾਂਦੀ ਹੈ ਪੰਜਾਬ ਦੇ ਵਿੱਚ ਫਿਲਮਾਂ ਗਾਣੇ ਮਸ਼ਹੂਰ ਕਲਾਕਾਰ ਵੀ ਪੰਜਾਬੀ ਵਿੱਚ ਹੀ ਆਪਣਾ ਇੰਟਰਟੇਨਮੈਂਟ ਦਾ ਨਜ਼ਰੀਆ ਸਾਹਮਣੇ ਲਿਆਉਂਦੇ ਹਨ ਇਸ ਲਈ ਸਾਨੂੰ ਪੰਜਾਬੀ ਬੋਲੀ ਦਾ ਸਭ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ